ਪੰਜਾਬ 'ਚ ਜਿਹੜੀ ਕਲਾ ਹੈ ਬਹੁਤ ਜ਼ਿਆਦਾ ਦਰਸਾਈ ਜਾਂਦੀ ਹੈ ਇਹਦੇ ਵਿੱਚ ਜਿਹੜੀਆਂ ਪੇਂਟਿੰਗਾਂ ਜਿਹੜੀਆਂ ਕੀਤੀਆਂ ਜਾਂਦੀਆਂ ਹਨ ਕੋਈ ਵੀ ਤਰ੍ਹਾਂ ਦੀ ਪੇਂਟਿੰਗ ਕੀਤੀ ਜਾਂਦੀ ਹੈ ਹੱਥ ਦੀ ਕਢਾਈ ਕੀਤੀ ਜਾਂਦੀ ਹੈ ਜੋ ਕਿ ਸੂਟਾਂ ਉੱਤੇ ਜਾਂ ਕਿਸੇ ਹੋਰ ਚੀਜ਼ਾਂ ਉੱਤੇ ਕਰਕੇ ਉਹਨੂੰ ਮਸ਼ਹੂਰ ਕੀਤਾ ਜਾਂਦਾ ਹੈ ਇੱਕ ਜਿਹੜੀ ਫੁਲਕਾਰੀ ਹੈ ਜਿਹੜੀ ਪੰਜਾਬ ਵਿੱਚ ਮਿਲਦੀ ਹੈ ਜੋ ਕਿ ਦੂਰੋਂ ਦੂਰੋਂ ਲੋਕ ਆ ਕੇ ਉਹ ਚੀਜ਼ ਨੂੰ ਪਸੰਦ ਕਰਦੇ ਹਨ ਉਹ ਆਪਣੇ ਉੱਪਰ ਲੈ ਕੇ ਦੇਖਦੇ ਹਨ ਫੁਲਕਾਰੀ ਫੁਲਕਾਰੀ ਦੇ ਸੂਟ ਦਿੱਤੇ ਮਿਲਦੇ ਹਨ ਫੁਲਕਾਰੀ ਦੀਆਂ ਚੱਪਲਾਂ ਵਾ ਜਿਹੜੀਆਂ ਪੰਜਾਬੀ ਚੱਪਲਾਂ ਹੁੰਦੀਆਂ ਉਹ ਮਿਲਦੀਆਂ ਜੋ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ ਪਸੰਦ ਆਉਂਦੀਆਂ ਨੇ ਜੋ ਕਿ ਦੂ ਲੋਕ ਬਾਹਰ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਮਾਲ ਜਿਹੜਾ ਉਹਨਾਂ ਦਾ ਸਪਲਾਈ ਕਰਦੇ ਹਨ ਇਹ ਚੀਜ਼ਾਂ ਪੰਜਾਬ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹਨ ਜਿਹੜੀਆਂ ਫੁਲਕਾਰੀ ਜਿਵੇਂ ਗਿੱਧੇ ਗਿੱਧੇ ਵਿੱਚ ਭੰਗੜੇ ਵਿੱਚ ਉੱਪਰ ਲਈਆਂ ਜਾਂਦੀਆਂ ਹਨ ਅਤੇ ਜਿਹੜੀਆਂ ਵੂਢਨ ਦੇ ਜਿਹੜੇ ਉਹ ਹੁੰਦੇ ਨੇ ਭਾਂਡੇ ਜਿਵੇਂ ਜਿਹਨੂੰ ਜਿਵੇਂ ਕਹਿ ਲਓ ਕਿ ਮਿੱਟੀ ਦੇ ਬਰਤਨ ਉਹ ਵੀ ਤਰ੍ਹਾਂ ਤਰ੍ਹਾਂ ਦੇ ਬਣਾਏ ਜਾਂਦੇ ਹਨ ਪੰਜਾਬ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪੰਜਾਬ ਵਿੱਚ ਮਤਲਬ ਮਿਲਦੀਆਂ ਨੇ ਜੋ ਕਿ ਹੋਰ ਕੋਈ ਦੇਸ਼ਾਂ ਵਿੱਚ ਮਿਲਦੀਆਂ ਹੀ ਨਹੀਂ ਬਿਲਕੁਲ ਅਤੇ ਜੇ ਪੇਂਟਿੰਗ ਦੀ ਲੈ ਲਓ ਮੂਰਤੀ ਲੈ ਲਓ ਜੋ ਵੀ ਹੈ ਜਿਹੜੀ ਵੀ ਕੋਈ ਚੀਜ਼ ਆ ਉਹ ਹਰ ਇੱਕ ਕਲਾ ਦੇ ਰੂਪ ਵਿੱਚ ਬਣਾਈ ਜਾਂਦੀ ਹੈ ਜੋ ਕਿ ਬਹੁਤ ਜ਼ਿਆਦਾ ਫੇਮਸ ਹੁੰਦੀ ਹੈ ਜੋ ਕਿ ਲੋਕ ਬਾਹਰੋਂ ਆ ਆ ਕੇ ਇਹਨਾਂ ਨੂੰ ਖ਼ਰੀਦ ਖ਼ਰੀਦ ਕੇ ਆਪਣੇ ਦੇਸ਼ਾਂ ਵਿੱਚ ਲੈ ਕੇ ਜਾ ਕੇ ਪਸੰਦ ਕਰਦੇ ਹਨ